ਸ਼ੂਗਰ ਤੋਂ ਬਚਣ ਲਈ ਸਾ ਡੇ ਪਿੰਡ ਵਿੱਚ ਬਥੇਰੇ ਨੁਸਖ਼ੇ ਨੇ ਜਿਵੇਂ ਅ ਨਿੰਮਮ ਦੇ ਪੱਤੇ ਕਰੇਲਿਆਂ ਦਾ ਜੂਸ ਅ ਮਿੱਠਾ ਮਿੱਠਾ ਬਿਲਕੁਲ ਨਹੀਂ ਖਾਣਾ ਉਹ ਮਖਾਨੇ ਕਰੇਲਿਆਂ ਦਾ ਅਚਾਰ ਧੰਨਵਾਦ